ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਆਪਣੇ ਘਰ ਵਿੱਚ ਬਹੁਤ ਸਾਰੇ ਪੌਦੇ ਲਗਾਏ ਹਨ ਅਤੇ ਕੁਛ ਫਲਾਵਰਸ ਦੇ ਅਤੇ ਕੁਛ ਸਬਜ਼ੀਆਂ ਦੇ ਅਤੇ ਸਬਜ਼ੀਆਂ ਦੇ ਅ ਪੌਦੇ ਮੇਰੇ ਬਹੁਤ ਵਧੀਆ ਚੱਲ ਰਹੇ ਹਨ ਅਤੇ ਫਲਾਵਰ ਦੇ ਵੀ ਅਤੇ ਮੇਰੇ ਵੀ ਮੇਰੇ ਪੌਦੇ ਗਰਮੀਆਂ 'ਚ ਵੀ ਵਧੀਆ ਰਹਿੰਦੇ ਹਨ ਅਤੇ ਸਰਦੀਆਂ ਵਿੱਚ ਵੀ ਵਧੀਆ ਰਹਿੰਦੇ ਹੈ ਜੂਨ ਜੁਲਾਈ ਦੇ ਮਹੀਨੇ ਵਿੱਚ ਥੋੜ੍ਹੀ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਮੈਂ ਉਹਨਾਂ ਵਿੱਚ ਪਾਣੀ ਦੋ ਟਾਈਮ ਪਾਉਂਦੀ ਆ ਜਿਸ ਕਰਕੇ ਮੇਰੇ ਪੌਦੇ ਮੁਰਝਾਉਂਦੇ ਨਹੀਂ ਆ ਅਤੇ ਮੇਰੀ ਇੰਨੇ ਵਧੀਆ ਪੌਦੇ ਲੱਗੇ ਹਨ ਕਿ ਫਲਾਵਰਸ ਫਲਾਵਰਸ ਵਾਲੇ ਪੌਦੇ ਬਹੁਤ ਵਧੀਆ ਚੱਲ ਰਹੇ ਹਨ ਸਬਜ਼ੀਆਂ ਵਾਲੇ ਵੀ ਅਤੇ ਮੈਂ ਕੁਛ ਸਬਜ਼ੀਆਂ ਗਮਲੇ ਵਿੱਚ ਵੀ ਲਗਾਈਆਂ ਹਨ ਅਤੇ ਉਹ ਗਮਲੇ ਵਿੱਚ ਵੀ ਬਹੁਤ ਵਧੀਆ ਲੱਗ ਰਹੀਆਂ ਹਨ ਅਤੇ ਉਹਨਾਂ ਵਿੱਚ ਫ਼ਲ ਫਰੂਟ ਬਹੁਤ ਜ਼ਿਆਦਾ ਪੈ ਰਿਹਾ ਫਰੂਟਿੰਗ ਵੀ ਹੋ ਰਹੀ ਹੈ ਫ਼ਲ ਵੀ ਪੈ ਰਹੇ ਹਨ ਸਬਜ਼ੀਆਂ ਵੀ ਲੱਗ ਰਹੀਆਂ ਹਨ ਅਤੇ ਅ ਮੈਂ ਮਤਲਬ ਕਿ ਕੁਛ ਪੌ ਫਰੂਟਾਂ ਦੇ ਪੌਦੇ ਲਗਾਏ ਹਨ ਕੁਝ ਸਬਜ਼ੀਆਂ ਦੇ ਕੁਛ ਫਲਾਵਰਸ ਦੇ ਅਤੇ ਮੇਰੇ ਮਤਲਬ ਕਿ ਲਾਗੇ ਛਾਗੇ ਗੁਆਂਡੀ ਜਿਹੜਾ ਹੁੰਦੇ ਆ ਉਹ ਘਰ ਆਉਂਦੇ ਹਨ ਅਤੇ ਉਹ ਦੇਖਦੇ ਹਨ ਕਿ ਮੈਂ ਫਲਾਵਰ ਅਤੇ ਫਰੂਟਾਂ ਦੇ ਅਤੇ ਫਰੂਟਾਂ ਦੇ ਅਤੇ ਮਤਲਬ ਕਿ ਸਬਜ਼ੀਆਂ ਦੇ ਪੌਦੇ ਲਗਾਏ ਹਨ ਜਿਵੇਂ ਕਿ ਮੈਂ ਤੋਰੀਆਂ ਬੈਂਗਣ ਚਿੱਟੇ ਬੈਂਗਣ ਅਤੇ ਭਰਥੇ ਵਾਲੇ ਬੈਂਗਣ ਅਤੇ ਅਹ ਮਤਲਬ ਕਿ ਫਲੀਆਂ ਘੀਆ ਅਤੇ ਗੇਂਦੇ ਦੇ ਫਲਾਵਰ ਰੋਜ਼ ਫਲਾਵਰ ਮੈਰੀਗੋਲਡ ਅਤੇ ਉਹ ਅਤੇ ਹੋਰ ਤਰੀਕੇ ਦੇ ਮਤਲਬ ਕਿ ਫਲਾਵਰ ਲਗਾਏ ਹਨ ਅਤੇ ਅਤੇ ਨਿੰਬੂ ਦੇ ਪੌਦੇ ਵੀ ਲਗਾਏ ਹਨ ਅਤੇ ਇਹਨਾਂ ਦੀ ਦੇਖ ਭਾਲ ਕਰਨ ਲਈ ਮੈਂ ਨਰਸਰੀ ਵਿੱਚ ਜਾਂਦੀ ਹਾਂ ਅਤੇ ਉਹਨਾਂ ਕੋਲ ਮਿੱਟੀ ਬਣਵਾਉਂਦੀ ਹਾਂ ਉਹ ਮਿੱਟੀ ਵਿੱਚ ਬੜਾ ਕੁਛ ਪਾਉਂਦੇ ਹਨ ਉਹ ਜਿਵੇਂ ਕਿ ਥੋੜ੍ਹਾ ਕੋਕੋਪੀਟ ਅਤੇ ਵਰਮੀ ਕੰਪੋਸਟ ਅਤੇ ਹੋਰ ਤਰ੍ਹਾਂ ਦੀ ਕੰਪੋਸਟਾਂ ਮਤਲਬ ਖਾਦਾਂ ਪਾਉਂਦੇ ਹਨ ਅਤੇ ਗੋਬਰ ਦੀ ਖਾਦ ਵੀ ਪਾਉਂਦੇ ਹਨ ਅਤੇ ਉਹਨਾਂ ਦਾ ਸਾਰਾ ਉਹ ਉਹ ਮਿੱਟੀ ਤਿਆਰ ਕਰਕੇ ਮੈਂ ਆਪਣੇ ਘਰ ਲੈ ਆਉਂਦੀ ਹਾਂ ਅਤੇ ਉਹ ਮਿੱਟੀ ਮੈਂ ਆਪਣੇ ਗਮਲਿਆ ਵਿੱਚ ਪਾ ਕੇ ਉਹਦੇ ਵਿੱਚ ਪੌਦਾ ਲਗਾ ਦਿੰਦੀ ਹਾਂ ਅਤੇ ਫਿਰ ਉਸ ਨੂੰ ਥੋੜ੍ਹਾ ਜਿਹਾ ਪਾਣੀ ਦੇ ਦਿੰਦੀ ਹਾਂ ਕਿ ਪੌਦਾ ਕੁਮਲਾਏ ਨਾ ਅਤੇ ਪਾਣੀ ਪੁਣੀ ਦੇਣ ਤੋਂ ਬਾਅਦ ਅਤੇ ਮੈਂ ਉਸ ਪੌਦੇ ਨੂੰ ਲਗਾ ਦਿੰਦੀ ਹਾਂ ਅਤੇ ਉਹ ਕੁਝ ਮੈਂ ਉਹਨਾਂ ਕੋਲ ਖਾਦ ਵਗੈਰਾ ਲੈ ਆਉਂਦੀ ਹਾਂ ਅਤੇ ਮੈਂ ਡੇਲੀ ਉਹਨਾਂ ਦੀ ਵਾਟਰਿੰਗ ਕਰਦੀ ਹਾਂ ਅਤੇ ਉਹਨਾਂ ਵਿੱਚ ਫਰੂਟਿੰਗ ਹੁੰਦੀ ਆ ਮੈਂ ਹਫ਼ਤੇ ਵਿੱਚ ਦੋ ਤਿੰਨ ਵਾਰੀ ਸਬਜ਼ੀ ਤੋੜ ਹੀ ਲੈਂਦੀ ਹਾਂ ਅਤੇ ਮੈਂ ਕੁਝ ਖਾਦਾਂ ਉਹਨਾਂ ਕੋਲ ਲੈ ਕੇ ਆਈ ਆਂ ਅਤੇ ਮੈਂ ਆਪਣੇ ਲਾਗੇ ਛਾਗੇ ਮੇਰੇ ਮੇਰੇ ਵੱਲ ਦੇਖ ਕੇ ਕਿੰਨੇ ਗੁਆਂਡੀਆਂ ਨੇ ਵੀ ਪੌਦੇ ਲਵਾ ਲਏ ਹਨ ਲਾ ਲਗਾ ਲਏ ਆ ਅਤੇ ਧੰਨਵਾਦ ਐ ਮੈਂ ਇੰਨਾ ਵਧੀਆ ਪੌਦੇ ਆਪਣੇ ਘਰ ਲਾਉਂਦੀ ਹਾਂ ਅਤੇ ਤੁਹਾਡਾ ਧੰਨਵਾਦ